ਹਾਂਜੀ ਮੈਂ ਨਾ ਇੱਕ ਕੂਲਰ ਮੰਗਵਾਇਆ ਸੀ ਆਪਣੇ ਐਮਾਜੋਨ ਐਪ ਤੋਂ ਜੀ ਹਾਂਜੀ ਉੱਥੇ ਨਾ ਸੇਲ ਲੱਗੀ ਹੋਈ ਸੀਗੀ ਉੱਥੇ ਅੱਧ ਰੇਟ 'ਤੇ ਮਿਲ ਰਹੇ ਸੀਗੇ ਜੀ ਕੂਲਰ ਜੀ ਹਾਂਜੀ ਅਤੇ ਮੈਨੂੰ ਵਧੀਆ ਲੱਗਿਆ ਵੇਖਣ 'ਚ ਵਧੀਆ ਕੂਲਰ ਸੀ ਫੁੱਲ ਸਾਈਜ਼ ਦਾ ਅਤੇ ਮੈਂ ਔਨਲਾਈਨ ਕਰਤਾ ਇੱਕ ਆਪਣੀ ਅਤੇ ਹਾਂਜੀ ਉਹ ਪਹਿਲਾਂ ਤਾਂ ਮੈਨੂੰ ਡਰ ਜਿਹਾ ਲੱਗੇ ਵੀ ਪਤਾ ਨਹੀਂ ਕਿਸ ਤਰ੍ਹਾਂ ਸਹੀ ਹੋਏਗਾ ਜਾਂ ਕਿਵੇਂ ਹੋਏਗਾ ਪਰ ਹਾਂ ਹੁਣ ਮੈਂ ਮੰਗਵਾਇਆ ਅਤੇ ਦੋ ਸਾਲ ਤੋਂ ਮੈਂ ਯੂਜ ਕਰ ਰਿਹਾ ਉਹ ਅਤੇ ਮੈਨੂੰ ਵਧੀਆ ਲੱਗ ਰਿਹਾ ਜੀ ਅਤੇ ਹੁਣ ਫਿਰ ਮੈਂ ਚ ਚਾਹੁੰਦਾ ਸੀ ਕਿ ਇੱਕ ਕੂਲਰ ਹੋਰ ਉਹਦੇ ਨਾਲ ਦਾ ਮੰਗਵਾਇਆ ਜਾਵੇ ਅਤੇ ਹੁਣ ਮੈਂ ਦੇਖ ਰਿਹਾ ਐਮਾਜੋਨ 'ਤੇ ਅਤੇ ਉਸ ਤਰ੍ਹਾਂ ਦੀ ਉਹ ਸੇਲ ਲੱਗ ਨਹੀਂ ਰਹੀ ਮਿਲ ਨਹੀਂ ਰਿਹਾ ਉਸ ਰੇਟ 'ਚ ਅਤੇ ਮੈਂ ਕਾਫੀ ਟਾਈਮ ਦਾ ਦੇਖ ਰਿਹਾ ਚੀਜ਼ ਅਤੇ ਵਧੀਆ ਸੀ ਕੂਲਰ ਉਹਦੇ ਪੂਰਾ ਮਤਲਬ ਫੁੱਲ ਵਧੀਆ ਕੂਲਿੰਗ ਕਾਲਿੰਗ ਸੀ ਉਹਦੀ ਉਹਦੀ ਹਵਾ ਸੀ ਉਹਦੀ ਫੁੱਲ ਅਤੇ ਮਟੀਰੀਅਲ ਵਧੀਆ ਲੱਗਿਆ ਹੋਇਆ ਸੀ ਉਹਦੇ 'ਤੇ ਕੂਲਰ 'ਤੇ ਪੂਰਾ ਵਧੀਆ ਸੀਗਾ ਜੀ ਅਤੇ ਹੁਣ ਮੈਂ ਦੇਖ ਰਿਹਾ ਐਮਾਜੋਨ 'ਤੇ ਵਾਰ ਵਾਰ ਕੋਈ ਆ ਨਹੀਂ ਰਿਹਾ ਉਹਦੇ 'ਤੇ ਕੋਈ ਐਡ ਸੇਲ ਲੱਗ ਨਹੀਂ ਰਹੀ